ਸਰਕਾਰੀ ਨੌਕਰੀ ਅਤੇ ਆਪਣੇ ਬਿਜਨਸ ਵਿੱਚ ਜੇਕਰ ਚੋਣ ਕਰਨੀ ਹੋਵੇ ਤਾਂ ਆਪਣਾ ਕਾਰੋਬਾਰ ਹੀ ਬਿਹਤਰ ਹੁੰਦਾ ਹੈ ਨੌਕਰੀ ਸਰਕਾਰੀ ਹੋਵੇ ਜਾਂ ਪ੍ਰਾਈਵੇਟ ਨੌਕਰੀ ਨੌਕਰ ਵਾਂਗ ਹੀ ਕਰਨੀ ਪੈਂਦੀ ਹੈ ਆਪਣੇ ਕਾਰੋਬਾਰ ਹੋਣਾ ਮਤਲਬ ਆਪਣੇ ਆਪ ਦਾ ਮਾਲਕ ਹੋਣਾ ਆਪਣਾ ਕਾਰੋਬਾਰ ਆਪਣਾ ਹੀ ਹੁੰਦਾ ਹੈ ਆਪਣੇ ਕਾਰੋਬਾਰ ਵਿੱਚ ਰੋਜ਼ ਆਮਦਨ ਹੁੰਦੀ ਹੈ ਜੋ ਨੌਕਰੀ ਵਿੱਚ ਰਹਿ ਕੇ ਵੀ ਨਹੀਂ ਹੁੰਦੀ ਨੌਕਰੀ ਨੌਕਰੀ ਵਿੱਚ ਮਹੀਨੇ ਬਾਅਦ ਹੀ ਤਨਖਾਹ ਮਿਲਦੀ ਹੈ ਜੋ ਕਿ ਇੱਕ ਵਧੀਆ ਗੱਲ ਨਹੀਂ ਕਾਰੋਬਾਰ ਵਿੱਚ ਰੋਜ਼ ਆਮਦਨ ਹੁੰਦੀ ਹੈ ਅਤੇ ਆਪਾਂ ਲੱਖਾਂ ਵਿੱਚ ਆਪਣੀ ਇਨਕਮ ਵਧਾ ਸਕਦੇ ਹਾਂ ਆਪਣੇ ਕਾਰੋਬਾਰ ਵਿੱਚ ਅਸੀਂ ਕਿਸੇ ਦੇ ਬੰਦਿਸ਼ ਨਹੀਂ ਹੁੰਦੇ ਅਸੀਂ ਆਪਣੇ ਟਾਈਮ ਅਨੁਸਾਰ ਆਪ ਵੀ ਗਤੀਵਿਧੀਆਂ ਨੂੰ ਪੂਰਾ ਕਰ ਸਕਦੇ ਹਾਂ ਕਾਰੋਬਾਰ ਵਿੱਚ ਬੰਦਾ ਆਪਣੇ ਘਰੇਲੂ ਕੰਮ ਵੀ ਕਰ ਸਕਦਾ ਹੈ ਅਤੇ ਆਪਣੇ ਘਰਦਿਆਂ ਨੂੰ ਟਾਈਮ ਵੀ ਦੇ ਸਕਦਾ ਹੈ ਜੋ ਕਿ ਨੌਕਰੀ ਵਿੱਚ ਮੁਸ਼ਕਲ ਹੁੰਦਾ ਹੈ ਆਪਣਾ ਕਾਰੋਬਾਰ ਸਾਡਾ ਰਹਿਣ ਸਹਿਣ ਬਹੁਤ ਵਧੀਆ ਕਰ ਦਿੰਦਾ ਹੈ ਆਪਣਾ ਕਾਰੋਬਾਰ ਵਿੱਚ ਬੰਦਾ ਫਾਨੈਂਸ਼ੀਅਲੀ ਸਟਰੋਂਗ ਹੁੰਦਾ ਹੈ ਉਹ ਆਪਣੇ ਪਰਿਵਾਰ ਦੇ ਹੋਰ

ਹੋਰਨਾਂ ਨੂੰ ਵੀ ਮਜ਼ਬੂਤ ਕਰਨ ਦੀ ਸਮਰੱਥਾ ਰੱਖਦਾ ਹੈ ਆਪਣੇ ਕਾਰੋਬਾਰ ਵਿੱਚ ਪੀੜ੍ਹੀ ਦਰ ਪੀੜ੍ਹੀ ਸ਼ੁਰੂ ਹੁੰਦਾ ਹੈ ਅਤੇ ਪੀੜ੍ਹੀ ਦਰ ਪੀੜ੍ਹੀ ਚੱਲਦਾ ਹੈ ਜਿਵੇਂ ਕਿ ਸਾਡਾ ਵੀ ਇੱਕ ਪੁਸ਼ਤੈਨੀ ਕਾਰੋਬਾਰ ਹੈ ਸਾਡੀ ਆਪਣੀ ਕੱਪੜੇ ਦੀ ਫੈਕਟਰੀ ਹੈ ਜਿਸ ਵਿੱਚ ਸ਼ਰਟ ਜੈਕਟ ਪੈਂਟ ਕੋਟ ਆਦਿ ਬਾਹਰ ਐਕਸਪੋਰਟ ਹੁੰਦੇ ਹਨ ਧੰਨਵਾਦ